ਸਾਡੇ ਘਰ ਦਿਨ ਵਿੱਚ ਲਗਭਗ ਅਠਾਰਾਂ ਘੰਟੇ ਬਿਜਲੀ ਆਉਂਦੀ ਹੈ ਕਿਸੇ ਘਰ ਵਿੱਚ ਬਿਜਲੀ ਦੀ ਉਪਲੱਬਧਤਾ ਆਮ ਤੌਰ 'ਤੇ ਸਥਾਨਕ ਪਾਵਰ ਗਰਿੱਡ ਦੀ ਭਰੋਸੇਯੋਗਤਾ 'ਤੇ ਨਿਰਭਰ ਕਰਦੀ ਹੈ ਅਕਸਰ ਚੌਵੀ ਸੱਤ ਸੇਵਾ ਪ੍ਰਦਾਨ ਕਰਦੀ ਹੈ ਹਾਲਾਂਕਿ ਆਊਟੇਜ ਹੋ ਸਕਦਾ ਹੈ ਬਿਜਲੀ ਕੱਟ ਵੱਖ ਵੱਖ ਮੌਸਮਾਂ ਵਿੱਚ ਰੋਜ਼ਾਨਾ ਜੀਵਨ ਨੂੰ ਮਹੱਤਵਪੂਰਨ ਰੂਪ ਵਿੱਚ ਪ੍ਰਭਾਵਿਤ ਕਰ ਸਕਦੇ ਹਨ ਗਰਮੀਆਂ ਵਿੱਚ ਏਅਰ ਕੰਡੀਸ਼ਨਿੰਗ ਅਤੇ ਕੂਲਿੰਗ ਪ੍ਰਣਾਲੀਆਂ ਦੇ ਨੁਕਸਾਨ ਦੇ ਕਾਰਨ ਆਊਟੇਜ ਬੇਅਰਾਮੀ ਦਾ ਕਾਰਨ ਬਣ ਸਕਦਾ ਹੈ ਜਿਸ ਨਾਲ ਅੰਦਰੂਨੀ ਤਾਪਮਾਨ ਅਸਹਿ ਹੋ ਸਕਦਾ ਹੈ ਅਤੇ ਫਰਿਜ ਵਿੱਚ ਭੋਜਨ ਖ਼ਰਾਬ ਹੋਣ ਦਾ ਖ਼ਤਰਾ ਹੋ ਸਕਦਾ ਹੈ ਸਰਦੀਆਂ ਵਿੱਚ ਬਿਜਲੀ ਦੇ ਕੱਟ ਹੀਟਿੰਗ ਪ੍ਰਣਾਲੀਆਂ ਵਿੱਚ ਵਿਘਨ ਪਾਉਂਦੇ ਹਨ ਜਿਸ ਦੇ ਨਤੀਜੇ ਵਜੋਂ ਅੰਦਰੂਨੀ ਤਾਪਮਾਨ ਠੰਡਾ ਹੁੰਦਾ ਹੈ ਜਿਸ ਨਾਲ ਬੇਅਰਾਮੀ ਅਤੇ ਸੰਭਾਵੀ ਸਹਿਤ ਜੋਖ਼ਮ ਹੋ ਸਕਦੇ ਹਨ ਦੋਵੇਂ ਮੌਸਮ ਅਰਾਮੀ ਰੋਸ਼ਨੀ ਅਤੇ ਖਾਣਾ ਪਕਾਉਣ ਦੀਆਂ ਚੁਣੌਤੀਆਂ ਦੇਖਦੇ ਹਨ ਰੋਜ਼ਾਨਾ ਰੂਟੀਨ ਅਤੇ ਸੁਰੱਖਿਆ ਨੂੰ ਪ੍ਰਭਾਵਿਤ ਕਰਦੇ ਹਨ ਇਸ ਲਈ ਪੂਰੇ ਸਾਲ ਘਰ ਵਿੱਚ ਅਰਾਮ ਸਿਹਤ ਅਤੇ ਕਾਰਜਕੁਸ਼ਲਾ ਬਣਾਈ ਰੱਖਣ ਨਿਰੰਤਰ ਬਿਜਲੀ ਜ਼ਰੂਰੀ ਹੈ